ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸੁਧਾਸ਼ੂ ਸ਼ਰਮਾ ਮੈਂ ਆਈ ਇਸ ਲੋ ਅੱਧੇ ਘੰਟੇ ਪਹਿਲਾਂ ਇੱਕ ਕੈਬ ਬੁੱਕ ਕੀਤੀ ਸੀ ਕਿਉਂਕਿ ਮੇਰੀ ਇੱਕ ਬਹੁਤ ਜ਼ਰੂਰੀ ਫਲਾਈਟ ਸੀ ਜੋ ਕਿ ਮੈਂ ਇੱਥੋਂ ਭਾਰਤ ਤੋਂ ਆਸਟਰੇਲੀਆ ਜਾਣਾ ਸੀ ਇਸ ਕਰਕੇ ਮੈਂ ਇੱਕ ਕੈਬ ਬੁੱਕ ਕੀਤੀ ਸੀ ਪਰ ਮੈਂ ਕੁਛ ਦੇਰ ਤੋਂ ਕੈਬ ਵਾਲੇ ਨੂੰ ਫੋਨ ਕਰ ਰਿਹਾ ਹਾਂ ਪਰ ਉਹ ਫੋਨ ਦਾ ਕੋਈ ਜਵਾਬ ਨਹੀਂ ਦੇ ਰਿਹਾ ਅਤੇ ਉਹ ਜਿਸ ਸਥਾਨ 'ਤੇ ਮੈਂ ਉਹਨੂੰ ਕਿਹਾ ਸੀ ਉਸ ਸਥਾਨ 'ਤੇ ਪੁੱਜ ਵੀ ਨਹੀਂ ਰਿਹਾ ਮੈਂ ਉਹਦਾ ਬਹੁਤ ਸਮਾਂ ਤੋਂ ਇੰਤਜ਼ਾਰ ਕਰ ਰਿਹਾ ਪਰ ਮੇਰੀ ਫਲਾਈਟ ਬਹੁਤ ਜ਼ਰੂਰੀ ਹੈ ਜਿਸ ਕਰਕੇ ਮੈਨੂੰ ਟੈਨਸ਼ਨ ਵੱਧਦੀ ਜਾ ਰਹੀ ਹੈ ਅਤੇ ਮੈਨੂੰ ਇਸ ਸਥਿਤੀ 'ਚ ਕਿਸੇ ਹੋਰ ਕੈਬ ਨੂੰ ਬੁੱਕ ਕਰਨਾ ਪਏਗਾ ਜਿਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਕੈਬ ਜੋ ਕਿ ਇੱਕ ਦੋ ਤਿੰਨ ਚਾਰ ਡਰਾਈਵਰ ਨੰਬਰ ਸੰਤੋਸ਼ ਕੁਮਾਰ ਸੀ ਉਸ ਨੂੰ ਰੱਦ ਕਰ ਦਿੱਤਾ ਜਾਵੇ ਜਾਂ ਕੈਂਸਲ ਕਰ ਦਿੱਤਾ ਜਾਵੇ ਕਿਉਂਕਿ ਮੈਂ ਬਹੁਤ ਸਮੇਂ ਤੋਂ ਉਡੀਕਣ ਤੋਂ ਬਾਅਦ ਮੈਂ ਦੂਸਰੀ ਕੈਬ ਬੁੱਕ ਕਰ ਲਈ ਹੈ ਕਿਉਂਕਿ ਫਲਾਈਟ ਪਕੜਨਾ ਮੇਰੇ ਲਈ ਬਹੁਤ ਜ਼ਰੂਰੀ ਸੀ ਅਤੇ ਮੈਂ ਫਲਾਈਟ ਮਿਸ ਨਹੀਂ ਕਰ ਸਕਦਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਇਹ ਜਾਣਕਾਰੀ ਨੂੰ ਸਗਿਆਨ 'ਚ ਲੈ ਕੇ ਉਸ ਡਰਾਈਵਰ ਨੂੰ ਛੇਤੀ ਤੋਂ ਛੇਤੀ ਕਹਿ ਕੇ ਆਪਣੇ ਕੈਂਸਲ ਕਰ ਲਵੋ ਔਲਾ ਉਬਰ ਦੀ ਰਾਈਡ ਤਾਂ ਕਿ ਹੋਰ ਕਿਸੇ ਬੰਦੇ ਨੂੰ ਜਿੱਥੇ ਜ਼ਰੂਰਤ ਹੋਵੇ ਉਹ ਸਮੇਂ ਸਿਰ ਪੁੱਜ ਸਕੇ ਅਤੇ ਮੈਂ ਵੀ ਆਪਣਾ ਕੰਮ ਕਰਨ ਲਈ ਸਮੇਂ ਸਿਰ ਏਅਰਪੋਰਟ 'ਤੇ ਪੁੱਜ ਸਕਾਂ ਮੈਂ ਮਾਫ਼ੀ ਚਾਹੁੰਦਾ ਹਾਂ ਪਰ ਇਸ ਵਿੱਚ ਤੁਹਾਡੇ ਕੈਬ ਡਰਾਈਵਰ ਦੀ ਵੀ ਬਹੁਤ ਗਲਤੀ ਸੀ ਸਮੇਂ ਸਿਰ ਨਹੀਂ ਪੁੱਜਣ ਦੀ ਜਿਸ ਕਰਕੇ ਮੈਨੂੰ ਦੂਜੀ ਕੈਬ ਬੁੱਕ ਕਰਨੀ ਪੈ ਗਈ